ਹੈਲੋ ਹਾਂਜੀ ਨਮਸਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂ ਹਾਂਜੀ ਐਕਸੀਡੈਂਟ ਹੁੰਦੇ ਹਨ

ਵੱਧ ਜਾਂਦਾ ਬੜੇ ਨੇ ਹਾਂਜੀ ਹਮ

ਬਹੁਤ ਜ਼ਿਆਦਾ ਹਨ ਕਰਦੇ ਨੇ ਸੰਭਾਲਦੇ ਹਨ ਬਸ ਤੋਂ ਬਾਹਰ ਰਹਿੰਦਾ ਹਾਂਜੀ

ਬਹੁਤ ਸੜਕਾਂ ਹੋ ਗਈਆਂ ਨੇ ਰਸ਼ ਬਹੁਤ ਰਹਿੰਦਾ ਹੈ

ਆਟੋ ਰਿਕਸ਼ਾ ਆਟੋ ਰਿਕਸ਼ਾ ਦਾ ਬੱਸਾਂ ਦਾ ਰਕਸ਼ਿਆਂ ਦਾ ਬਹੁਤ ਰਸ਼ ਰਹਿੰਦਾ ਹੈ ਬਹੁਤ ਹਨ

ਹਾਂਜੀ ਪਹਿਲਾਂ ਨਾਲੋ ਇੰਤਜ਼ਾਮ ਤਾਂ ਨਹੀਂ ਚੰਗਾ ਇੰਤਜਾਮ ਕਰਨ ਵਧੀਆ ਹਾਂਜੀ ਹਾਜੀ